ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮਿਨ ਮੇਰਾ ਨਾਮ ਕਨੂੰ ਪ੍ਰਿਆ ਹੈ ਅਤੇ ਮੈਂ ਅਸਲ 'ਚ ਨਾ ਇੱਥੇ ਗੁਰਦਾਸਪੁਰ ਨਵੀਂ ਆਈ ਹਾਂ ਅਤੇ ਮੈਨੂੰ ਤੁਹਾਡਾ ਨੰਬਰ ਨਾ ਉੱਥੋਂ ਮੇਰੀ ਫਰੈਂਡ ਸ਼ਰੂਤੀ ਨੇ ਦੱਸਿਆ ਸੀ ਕਿ ਤੁਸੀਂ ਬਹੁਤ ਵਧੀਆ ਟੂਰਿਸਟ ਗਾਈਡ ਹੋ ਅਸਲ 'ਚ ਨਾ ਮੈਨੂੰ ਵਾਹਗਾ ਬੋਡਰ ਦੇਖਣ ਜਾਣਾ ਹੈ ਗੁਰਦਾਸਪੁਰ ਤੋਂ ਅੰਮ੍ਰਿਤਸਰ ਵਾਸਤੇ ਵਾਹਗਾ ਬੋਡਰ ਵਾਸਤੇ ਅਤੇ ਤੁਸੀਂ ਮੈਨ ਤੁਸੀਂ ਤੁਹਾਡੀ ਕੀ ਪੇਮੈਂਟਸ ਆ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਹਾਂਜੀ ਅਸਲ 'ਚ ਆਪਾਂ ਪੰਜ ਤੋਂ ਛੇ ਜਾਣੇ ਹਾਂ ਹਾਂਜੀ ਸਰ ਹਾਂਜੀ ਸਰ ਠੀਕ ਹੈ ਸਰ ਮੈਂ ਆਪਣੇ ਪੇ ਆਪਣੇ ਫਰੈਂਡਸ ਦੇ ਨਾਲ ਮਿਲ ਕੇ ਤੁਹਾਡੇ ਨਾਲ ਗੱਲ ਕਰ ਦੇਵਾਂਗੀ ਮੈਂ ਉਨ੍ਹਾਂ ਨੂੰ ਇੱਕ ਵਾਰੀ ਪੁਛ ਲਵਾਂ ਹਾਂਜੀ ਸਰ ਹਾਂਜੀ ਸਰ ਥੈਂਕਯੂ